ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਜੀ ਦੇਖੋ ਮੈਮ ਸਾਡੇ ਕੋਲ ਸਿਲਵਰ ਦੀਆਂ ਵੀ ਕਈ ਜੂਲਰਸ ਨੇ ਜੂਲਰੀ ਨੇ ਗੋਲਡ ਦੀਆਂ ਵੀ ਨੇ ਤੁਸੀਂ ਦੱਸੋ ਤੁਹਾਡੀ ਜ਼ਿਆਦਾ ਕਿਹਦੇ ਵਿੱਚ ਹੈ ਤੁਸੀਂ ਕਿਹਦੇ 'ਚ ਲੈਣੀ ਆ ਆਰਟੀਫਿਸ਼ਲ ਜੂਲਰੀ ਅਸੀਂ ਜਵੈਲਰੀ ਮਤਲਬ ਜ਼ਿਆਦਾਕਰ ਗੋਲਡ ਜਾਂ ਸਿਲਵਰ 'ਚ ਈ ਬਣਾਉਂਦੇ ਹਾਂ ਆਰਟੀਫਿਸ਼ਲ ਵਾਲਾ ਸਾਡਾ ਮਤਲਬ ਕੰਮ ਨਹੀਂ ਆ ਉੱਧਰ ਦੇ ਖੇਤਰ 'ਚ ਹਾਂਜੀ ਹਾਂਜੀ ਹਾਂਜੀ ਸਾਡੇ ਕੋਲ ਬ ਪਹਿਲਾਂ ਦੇਖੋ ਬਾਈ ਕੈਰਟ ਤੇਈ ਹਜ਼ਾਰ ਕੈਰਟ ਅਤੇ ਚੌਵੀ ਕੈਰਟ ਇਹ ਤਿੰਨ ਤਰ੍ਹਾਂ ਦੇ ਗੋਲਡ ਆਉਂਦੇ ਆ ਅਤੇ ਅੱਜ ਕੱਲ੍ਹ ਜੋ ਰੇਟ ਚੱਲ ਰਿਹਾ ਬਾਈ ਕੈਰਟ ਦਾ ਉਹ ਹੈਗਾ ਵਾ ਕੁਛ ਸੱਤਰ ਹਜ਼ਾਰ ਦੇ ਲਾਗੇ ਛਾਗੇ ਆ ਅਤੇ ਅਸੀਂ ਉਹਦੇ ਗੋਲਡ ਵਿੱਚ ਪੈਂਡੈਂਟ ਵੀ ਬਣਾ ਦਿੰਦੇ ਹਾਂ ਜਾਂ ਨੈਕਲੈਸ ਹੋ ਗਿਆ ਬਰੈਸਲੈਟ ਹੋ ਗਿਆ ਕਾਂਟੇ ਹੋ ਗਏ ਤੁਸੀਂ ਜੋ ਚਾਹੋਗੇ ਅਸੀਂ ਉਹ ਬਣਾ ਦਾਂਗੇ ਸਾਡੇ ਮੇਕਿੰਗ ਚਾਰਜਿਸ ਲਗਭਗ ਜੋ ਹੈ ਉਹ ਹੋਊਗੇ ਹਜ਼ਾਰ ਕੁ ਰੁਪਈਆ ਹੋਵੇਗਾ ਜੋ ਕਿ ਸਾਡੀ ਜੋ ਲੇਬਰ ਨੂੰ ਲੱਗੇਗਾ ਤੇ ਪਪਾ ਤੁਹਾਡੇ ਵਾਸਤੇ ਅਸੀਂ ਇੱਕ ਸਪੈਸ਼ਲ ਆਫਰ ਲੈ ਕੇ ਆਏਗਾ ਆਵਾ ਆਵਾਂਗੇ ਅਤੇ ਉਹਦੇ ਵਿੱਚ ਅਸੀਂ ਤੁਹਾਨੂੰ ਘੱਟੋ ਘੱਟ ਸੱਤ ਕੁ ਪ੍ਰਸੈਂਟ ਦਾ ਪ੍ਰਤੀਸ਼ਤ ਦਾ ਡਿਸਕਾਊਂਟ ਜ਼ਰੂਰ ਦੇਵਾਂਗੇ ਹਾਂਜੀ ਹਾਂਜੀ ਅਸੀਂ ਬਕਾਇਦਾ ਹੋਲਮਾਰਕ ਲਗਾ ਕੇ ਦੇਈਦਾ ਅਤੇ ਤੁਹਾਨੂੰ ਉਸ ਟਾਈਮ ਅਸੀਂ ਟੈਸਟ ਵੀ ਕਰਵਾ ਕੇ ਦੇਵਾਂਗੇ ਨਹੀਂ ਨਹੀਂ ਸਾਡੇ ਕੋਲ ਮਤਲਬ ਹਾਂ ਸਾਡੇ ਕਾਫ਼ੀ ਡਿਜ਼ਾਇਨ ਸਾਡੀ ਬੁਕਲੈਟਸ ਵਿੱਚ ਵੀ ਪਏ ਨੇ ਅਤੇ ਅਸੀਂ ਜੋ ਤੁਸੀਂ ਡਿਜ਼ਾਇਨ ਸਾਨੂੰ ਕੱਢ ਕੇ ਦਓਗੇ ਅਸੀਂ ਉਹ ਵੀ ਡਿਜ਼ਾਇਨ ਦੇ ਬਣਾ ਸਕਦੇ ਹਾਂ ਨਹੀਂ ਜੀ ਸਾਡੇ ਹਰੇਕ ਕਿਸਮ 'ਤੇ ਨਾ ਅਲੱਗ ਅਲੱਗ ਚਾਰਜਿਸ ਆ ਜਿਵੇਂ ਕਿ ਗੋਲਡ 'ਤੇ ਅਸੀਂ ਥੋੜ੍ਹਾ ਜ਼ਿਆਦਾ ਮਿਹਨਤ ਲੱਗਦੀ ਹੈ ਸਾਡੇ ਲੇਬਰ ਦੀ ਨਾ ਜ਼ਿਆਦਾ ਹਜ਼ਾਰ ਕੁ ਤੀਕਰ ਲੱਗ ਜਾਂਦੇ ਸਿਲਵਰ 'ਤੇ ਤਾਂ ਅਸੀਂ ਮਸਾ ਕੁ ਦੋ ਸੌ ਕੁ ਚਾਰਜਿਸ ਲਈਦੇ ਆ ਹਾਂਜੀ ਅਸੀਂ ਤੁਹਾਨੂੰ ਬਕਾਇਦਾ ਬਿੱਲ ਬਣਾ ਕੇ ਦੇਵਾਂਗੇ ਬਿਲ ਨਾਲ ਅਸੀਂ ਪੂਰਾ ਤੁਹਾਨੂੰ ਜੋ ਵੀ ਗੋਲਡ ਵਿੱਚ ਵਰਤਿਆ ਗਿਆ ਆ ਉਹਦੀ ਵੀ ਪੂਰੀ ਇਨਫੋਰਮੇਸ਼ਨ ਲਿਖ ਕੇ ਵਿੱਚ ਦੇਵਾਂਗੇ ਤੇ ਤਾਂ ਕਿ ਤੁਸੀਂ ਸਾਡੀ ਹਾਂਜੀ ਸਾਡੀ ਦੁਕਾਨ ਮਤਲਬ ਕਿ ਸਵੇਰ ਨੂੰ ਦਸ ਵਜੇ ਤੋਂ ਲੈ ਕੇ ਸ਼ਾਮ ਦੇ ਅੱਠ ਵਜੇ ਤੱਕ ਖੁੱਲ੍ਹੀ ਹੁੰਦੀ ਹੈ ਜੋਤੀ ਚੌਂਕ ਕੋਲ ਹੈ ਅਤੇ ਤੁਸੀਂ ਕਦੋਂ ਵੀ ਆ ਕੇ ਸਾਨੂੰ ਮਿਲ ਸਕਦੇ ਹੋ ਹਾਂਜੀ ਤੁਸੀਂ ਮੈਨੂੰ ਆਪਣੇ ਡਿਜ਼ਾਇਨ ਵੀ ਭੇਜ ਦਿਓ ਅਤੇ ਮੈਂ ਵੀ ਤੁਹਾਨੂੰ ਆਪਣੇ ਦਿਖਾਦੁੰਗਾ ਚਲੋ ਠੀਕ ਓਕੇ ਠੀਕ ਧੰਨਵਾਦ ਜੀ